ਜਲੰਧਰ ਦੇ ਵਿੱਚ ਚਾਰ ਯੂਨੀਵਰਸਿਟੀਜ਼ ਹਨ ਜਿਹਦੇ ਵਿੱਚ ਇੱਕ ਨੈਸ਼ਨਲ ਇੰਸਟੀਟਿਊਟ ਆਫ ਟੈਕਨੋਲੋਜੀ ਜਿਹੜਾ ਕੇਂਦਰ ਸਰਕਾਰ ਵੱਲੋਂ ਚਲਾਇਆ ਜਾਂਦਾ ਹੈ ਇੱਕ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੈ ਇੱਕ ਡੀ ਏ ਵੀ ਯੂਨੀਵਰਸਿਟੀ ਹੈ ਇੱਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰੀਜਨਲ ਕੈਂਪਸ ਵੀ ਹੈ ਤੋ ਇਸ ਸੰਬੰਧਿਤ ਖੇਤਰ ਦੇ ਵਿੱਚ ਰਿਸਰਚ ਵਾਸਤੇ ਚਾਹੇ ਉਹ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਨੇਜਮੈਂਟ ਕਿਸੇ ਵੀ ਫੀਲਡ ਦੇ ਨਾਲ ਰਿਲੇਟਡ ਹੋਵੇ ਬਹੁਤ ਹੀ ਉਚੇਰੇ ਮਿਆਰ ਦੀ ਰਿਸਰਚ ਜਿਹੜੀ ਆ ਉਹ ਇਸ ਜ਼ਿਲ੍ਹੇ ਦੇ ਵਿੱਚ ਕੀਤੀ ਜਾ ਰਹੀ ਹੈ ਇਹਦੇ ਵਿੱਚ ਇਹ ਵੀ ਦੇਖਣਾ ਔਰ ਬੜਾ ਸ਼ਲਾਘਾਯੋਗ ਹੈ ਕਿ ਡੀ ਏ ਵੀ ਯੂਨੀਵਰਸਿਟੀ ਦੇ ਜਿਹੜੇ ਕੁਝ ਦੋ ਪ੍ਰੋਫੈਸਰ ਹਨ ਉਹ ਪੂਰੀ ਦੁਨੀਆਂ ਦੇ ਟੋਪ ਟੂ ਪਰਸੈਂਟ ਸਾਇੰਟਿਸਟ ਦੇ ਵਿੱਚ ਸ਼ੁਮਾਰ ਹਨ ਇਸੇ ਤਰ੍ਹਾਂ ਹੀ ਇਹ ਚਾਰੋਂ ਯੂਨੀਵਰਸਿਟੀਜ਼ ਜਿਹੜੀਆਂ ਨੇ ਉਹਨਾਂ ਕੋਲ ਨੈਕ ਦਾ ਬਹੁਤ ਉਚੇਰਾ ਗ੍ਰੇਡ ਹੈ ਜਿਹੜਾ ਇਹ ਸਾਬਿਤ ਕਰਦਾ ਹੈ ਕਿ ਇੱਥੇ ਪੇਟੈਂਟ ਹੋਵੇ ਰਿਸਰਚ ਪੇਪਰ ਹੋਣ ਡਾਕਟਰੇਅਲ ਗਾਈਡੈਂਸ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇਹਨਾਂ ਯੂਨੀਵਰਸਿਟੀਜ਼ ਨੇ ਬਹੁਤ ਜ਼ਿਆਦਾ ਸ਼ਲਾਘਾਯੋਗ ਕੰਮ ਕੀਤਾ ਹੈ ਜਿਸ ਵਜ੍ਹਾ ਦੇ ਨਾਲ ਇਸ ਪੂਰੇ ਖੇਤਰ ਦਾ ਨਾਮ ਜਿਹੜਾ ਆ ਉਹ ਰੌਸ਼ਨ ਕੀਤਾ ਗਿਆ ਹੈ ਧੰਨਵਾਦ